ਐਲ ਪੀ ਜੀ ਗੈਸ ਆਉਣ ਤੋਂ ਪਹਿਲਾਂ ਅਸੀਂ ਚੁੱਲ੍ਹੇ ਦੀ ਵਰਤੋਂ ਕਰਦ ਪਿੰਡਾਂ ਵਿੱਚ ਚੁੱਲ੍ਹੇ ਦੀ ਵਰਤੋਂ ਕਰਦੇ ਸਨ ਅਤੇ ਜਦੋਂ ਦੀ ਐਲ ਪੀ ਜੀ ਗੈਸ ਆਈ ਆ ਸਾਨੂੰ ਬਹੁਤ ਸੁਖਾਲਾ ਹੋ ਗਿਆ ਇਮੀਜੇਟਲੀ ਚਾਹ ਬਣ ਜਾਂਦੀ ਆ ਸਬਜ਼ੀ ਅਤੇ ਖਾਣਾ ਇਮੀਜੇਟਲੀ ਰੋਟੀ ਤਿਆਰ ਹੋ ਜਾਂਦੀ ਆ ਪਰ ਇਸਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਜੇ ਮਾੜੀ ਮੋਟੀ ਪੇੈਪ ਲੀਕ ਕਰ ਜਾਵੇ ਤਾਂ ਘਰਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਖੰਡਾਂ ਨੂੰ ਅੱਗ ਲੱਗਕੇ ਮਕਾਨ ਨਸ਼ਟ ਹੋ ਜਾਂਦੇ ਹਨ ਇਸ ਕਰਕੇ ਗੈਸ ਨੂੰ ਲੀਕੇਜ ਪੈਪ ਰਾਹੀ ਸਾਲ ਬਾਅਦ ਪੈਪ ਨਵਾਂ ਬਦਲਣਾ ਚਾਹੀਦਾ ਹੈ ਰੈਗੁਲੇਟਰ ਦੀ ਦੇਖਭਾਲ ਕਰਨੀ ਚਾਹੀਦੀ ਹੈ ਕਿਸੇ ਸਮੇਂ ਵੀ ਸਮੈਲ ਆਵੇ ਤਾਂ ਦਰਵਾਜੇ ਖਿੜਕੀਆਂ ਸਾਰੀਆਂ ਖੋਲਣੀਆਂ ਚਾਹੀਦੀਆਂ ਹਨ ਸੁੱਚ ਵਗੈਰਾ ਨਹੀਂ ਆਨ ਕਰਨੇ ਚਾਹੀਦੇ